ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਘਰ 'ਚ ਖਾਣਾ ਪਕਾਉਣ ਲਈ ਐੱਲ ਪੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਕੀ ਕੀ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਹਾਂਜੀ ਸਰ ਜਿਵੇਂ ਕਿ ਪਹਿਲਾਂ ਅਸੀਂ ਆਮ ਲੋਕ ਚੁੱਲ੍ਹਿਆਂ ਵਿੱਚ ਅੱਗ ਬਾਲਦੇ ਸੀਗੇ ਚਲੋ ਸੌਖਾ ਸੀ ਕੰਮ ਪਰ ਹੁਣ ਜੋ ਐੱਲ ਪੀ ਜੀ ਗੈਸ ਸਿਲੰਡਰ ਆ ਸਮਝ ਲਉ ਘਰ ਵਿੱਚ ਇੱਕ ਬੰਬ ਦੀ ਤਰ੍ਹਾਂ ਹੈ ਜੋ ਕਿ ਅਸੀਂ ਜਾਂ ਅਚਨਚੇਤ ਸਾਡੇ ਬੱਚਿਆਂ ਨੇ ਉਹ ਚੱਲਦਾ ਛੱਡਤਾ ਜਾਂ ਕਿਤੇ ਸ਼ੋਟ ਸਰਕਟ ਹੋ ਗਿਆ ਜਾਂ ਕਿਤੇ ਘਰ ਵਿੱਚ ਤੀ ਉਹਨਾਂ ਨੇ ਤੀਲੀ ਵਗੈਰਾ ਮਚਾਤੀ ਤਾਂ ਉਹ ਕਿਸੇ ਸਮੇਂ ਵੀ ਭਾਈ ਅੱਗ ਲੱਗ ਸਕਦੀ ਹੈ ਇਸ ਇਹਨੂੰ ਬਚਾਉਣ ਦੇ ਲਈ ਸਰ ਉਹਨੂੰ ਪਹਿਲਾਂ ਅੱਗ ਨੂੰ ਕੰਟਰੋਲ ਕਰਨਾ ਪਊ ਠੀਕ ਹੈ ਸਰ ਜੀ ਜਾਂ ਫਿਰ ਉਹਨੂੰ ਭਾਈ ਪਹਿਲਾਂ ਹੀ ਬੰਦ ਕਰ ਦਿਉ ਬੰਦ ਕਰਨ ਤੋਂ ਬਾਅਦ ਠੀਕ ਹੈ ਸਰ ਜੀ ਇਹਦੀ ਇਹ ਸ ਬਹੁਤ ਸੁਰੱਖਿਆ ਨੇ ਸਰ ਜੀ ਜਿਵੇਂ ਕਿ ਖਾਣਾ ਛੇਤੀ ਬਣ ਜਾਂਦਾ ਸਾਫ ਸੁਥਰਾ ਭਾਂਡਾ ਬਰਤਨ ਵਗੈਰਾ ਕਾਲੇ ਨਹੀਂ ਹੁੰਦੇ ਸਰ ਸਮੇਂ ਦੀ ਬੱਚਤ ਹੋ ਜਾਂਦੀ ਹੈ ਖਾਣਾ ਜਾਣੀ ਕਿ ਸਮੇਂ ਦੇ ਨਾਲ ਬਣ ਜਾਂਦਾ ਸਰ ਐੱਲ ਪੀ ਜੀ ਗੈਸ ਨਾਲ ਅਤੇ ਜਿਹੜਾ ਕਿ ਰੂਮ ਸਾਫ ਸੁਥਰਾ ਰਹਿੰਦਾ ਧੂੰਆਂ ਵਗੈਰਾ ਨਹੀਂ ਹੁੰਦਾ ਸਰ ਜੀ ਸ਼ਾਂਤੀ ਸ਼ਾਂਤੀ ਪੂਰਵਕ ਤਰੀਕੇ ਨਾਲ ਖਾਣਾ ਬਣ ਜਾਂਦਾ ਥੈਂਕ ਯੂ